ਉਸ ਤੋਂ ਇਲਾਵਾ ਜੋ ਸਾਡਾ ਵਿਸਾਖੀ ਦਾ ਤਿਉਹਾਰ ਹੈ ਜੋ ਖਾਲਸਾ ਪੰਥ ਦਾ ਖਾਲਸਾ ਸਾਜਨਾ ਦਿਵਸ ਵਿ ਵਜੋਂ ਵੀ ਜਾਣਿਆ ਜਾਂਦਾ ਅਤੇ ਇਸ ਤਰ੍ਹਾਂ ਦੀਵਾਲੀ ਦੇ ਉੱਪਰ ਜੋ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਅਤੇ ਸਿੱਖਿਆ ਹੈ ਸਿੱਖਿਆ ਅਤੇ ਸਿੱਖੀ ਦੇ ਅਨੁਸਾਰ ਜੋ ਸਿੱਖਿਆ ਹੈ ਉਹ ਸਾਰਿਆਂ ਲਈ ਸਾਂਝੀ ਸਾਰੇ ਧਰਮਾਂ ਲਈ ਅਤੇ ਇਹਦੇ ਵਿੱਚ ਕੀ ਹੈ ਦੋ ਤਰ੍ਹਾਂ ਦੀ ਸਿੱਖਿਆ ਏ ਇੱਕ ਨੈਤਿਕ ਸਿੱਖਿਆ ਹੈ ਇੱਕ ਵਿੱਦਿਅਕ ਸਿੱਖਿਆ ਹੈ ਅਤੇ ਇਸ ਤਰ੍ਹਾਂ ਹੀ ਸਾਡੇ ਜੋ ਸੇਵਾ ਦੇ ਹੋਰ ਸਮਾਜ ਦੇ ਵਿੱਚ ਜਿਹੜੀ ਕ੍ਰਿਤੀਆਂ ਚੱਲ ਰਹੀਆਂ ਨੇ ਜਾਂ ਹੋਰ ਕੋਈ ਭਲਾਈ ਦੇ ਕੰਮ ਨੇ ਉਹਦੇ ਵਿੱਚ ਜਿਵੇਂ ਦਰੱਖਤ ਲਗਾਉਣੇ ਆਪਣੇ ਬਲੱਡ ਡੋਨੇਸ਼ਨ ਕੈਂਪ ਹੋ ਗਏ ਜਾਂ ਇਸ ਤਰ੍ਹਾਂ ਦੇ ਹੋਰ ਕਾਰਜ ਜਿਹੜੇ ਨੇ ਉਹ ਅਸੀਂ ਕਰ ਸਕਦੇ ਹਾਂ ਉਹ ਜੋ ਸਿੱਖ ਧਰਮ ਦਾ ਉਪਦੇਸ਼ ਹੈ ਜੋ ਗੁਰੂ ਸਾਹਿਬ ਦੇ ਸਮੇਂ ਵੀ ਹੁੰਦੇ ਰਹੇ ਨੇ ਅਤੇ ਬਾਅਦ ਚ ਵੀ ਚੱਲ ਰਹੇ ਨੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਇਹ ਇਸ ਤਰ੍ਹਾਂ ਅਸੀਂ ਆਪਣੇ ਜੋ ਧਾਰਮਿਕ ਗਤੀਵਿਧੀਆਂ ਨੇ ਜਾਂ ਪਹਿਲਕਦਮੀਆਂ ਨੀਤੀਆਂ ਨੇ ਜਿਨਾਂ ਦਾ ਉਦੇਸ਼ ਹੈਗਾ ਆਪਸ ਵਿੱਚ ਧਰਮ ਜਿਹੜੇ ਆ ਉਹ ਕੰਮ ਕਰਦੇ ਰਹਿਣ ਰਲ ਮਿਲ ਕੇ ਲੋਕ ਜਿਹੜੇ ਨੇ ਭਾਈਚਾਰਕ ਤੌਰ 'ਤੇ ਜੁੜੇ ਰਹਿਣ ਇੱਕ ਦੂਸਰੇ ਨਾਲ ਇਹੀ ਸਾਡਾ ਇੱਥੋਂ ਦਾ ਪ੍ਰਮੁੱਖ ਉਦੇਸ਼ ਹੈ ਜੀ